ਮੈਂ ਔਨਲਾਈਨ ਮਤਲਬ ਕਿ ਫੈਨ ਮੰਗਵਾਇਆ ਸੀਗਾ ਅਤੇ ਫੈਨ ਬੜਾ ਅੱਛਾ ਆਇਆ ਉਹਦੀ ਡਿਲੀਵਰੀ ਵੀ ਬੜੀ ਫਾਸਟ ਹੋਈ ਮਤਲਬ ਕਿ ਫੈਨ ਓਰੀਐਂਟ ਦਾ ਫੈਨ ਸੀਗਾ ਮਤਲਬ ਕਿ ਉਹਨੂੰ ਡਿਲੀਵਰੀ ਵੀ ਉਹਨਾਂ ਨੇ ਦੋ ਦਿਨਾਂ ਦੇ ਅੰਦਰ ਅੰਦਰ ਹੀ ਦੇ ਦਿੱਤੀ ਬੜਾ ਅੱਛਾ ਪ੍ਰੋਡਕਟ ਨਿਕਲਿਆ ਮੈਂ ਉਹ ਨੂੰ ਯੂਜ ਕੀਤਾ ਜਿਵੇਂ ਗਰਮੀਆਂ ਦੇ ਵਿੱਚ ਮੈਂ ਮੰਗਵਾਇਆ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀਗੀ ਇੰਨੀ ਗਰਮੀ ਸੀ ਪਰ ਮੈਨੂੰ ਉਹਦੇ ਫੰਕਸ਼ਨਸ ਬੜੇ ਅੱਛੇ ਲੱਗੇ ਬੜਾ ਵਧੀਆ ਲੱਗਿਆ ਉਹ ਪੱਖਾ ਮੰਗਵਾ ਕੇ ਕਿ ਮੇਰਾ ਮਨ ਹੈ ਕਿ ਮੈਂ ਸ਼ਾਇਦ ਇੱਕ ਦੋ ਫੈਨ ਹੋਰ ਮੰਗਵਾ ਲਾ ਉਹਨੂੰ ਜਿੱਥੇ ਉਹਦਾ ਵੇਟ ਵੀ ਨਹੀਂ ਆ ਵੇਟ ਲੈਸ ਹੈ ਵਿਦ ਨਾਲ ਰਿਮੋਟ ਕੰਟਰੋਲ ਹੈ ਉਹਦੇ ਨਾਲ ਉਹਨੂੰ ਜਿਸ ਤਰ੍ਹਾਂ ਮਰਜ਼ੀ ਰਾਈਟ ਲੈਫਟ ਜਿਸ ਤਰ੍ਹਾਂ ਮਰਜ਼ੀ ਕਰ ਲਉ ਸੱਜੇ ਖੱਬੇ ਜਿੱਧਰ ਮਰਜ਼ੀ ਮੋੜ ਲਉ ਪਰ ਅੱਛਾ ਲੁਕ ਵਾਈਜ਼ ਵੀ ਉਹ ਦੇਖਣ ਨੂੰ ਬੜਾ ਅੱਛਾ ਲੱਗਦਾ ਲਾਈਟਸ ਵਗੈਰਾ ਵੀ ਉਹਦੇ ਵਿੱਚ ਨੇ ਮਤਲਬ ਕਿ ਕਲਰ ਵੀ ਉਹਨਾਂ ਨੇ ਬਹੁਤ ਸੋਹਣਾ ਭੇਜਿਆ ਜਿੱਦਾਂ ਦੀ ਚੀਜ਼ ਮੈਨੂੰ ਚਾਹੀਦੀ ਸੀ ਉਹਨਾਂ ਨੇ ਉੱਦਾਂ ਦਾ ਹੀ ਪ੍ਰੋਡਕਟ ਮੈਨੂੰ ਭੇਜਿਆ ਔਨਲਾਈਨ ਮੰਗਵਾ ਕੇ ਮੈਨੂੰ ਚੀਜ਼ ਮੰਗਵਾ ਕੇ ਬਹੁਤ ਅੱਛਾ ਲੱਗਿਆ ਵਧੀਆ ਲੱਗਿਆ ਮਜ਼ਾ ਆਇਆ ਕਿ ਮੈਂ ਚੀਜ਼ ਮੰਗਵਾਈ ਹੈ ਜਾਂ ਮੈਂ ਪੈਸੇ ਖਰਚੇ ਹੈ ਅਤੇ ਵਧੀਆ ਮੇਰੀ ਪਸੰਦ ਦੀ ਹੈ ਸ਼ਾਇਦ ਮੈਂ ਬਾਜ਼ਾਰੋਂ ਵੀ ਲੈਣ ਜਾਂਦੀ ਤਾਂ ਮੈਨੂੰ ਇਹੋ ਜਿਹੀ ਚੀਜ਼ ਨਾ ਮਿਲਦੀ ਪਰ ਜੋ ਮੈਨੂੰ ਔਨਲਾਈਨ ਇਹਨਾਂ ਨੇ ਫਲਿਪਕਾਰਟ ਤੋਂ ਮੈਂ ਮੰਗਵਾਇਆ ਸੀ ਪਰ ਅੱਛਾ ਹੈ ਪਰ ਉਹਨਾਂ ਦੇ ਹੋਰ ਵੀ ਪ੍ਰੋਡਕਟ ਬਹੁਤ ਅੱਛੇ ਨੇ ਕਈ ਮੈਂ ਇੱਕ ਦੋ ਚੀਜ਼ਾਂ ਹੋਰ ਵੀ ਮੰਗਵਾਈਆਂ ਨੇ ਉਹਨਾਂ ਦੇ ਵੀ ਬੈਨੀਫਿਟ ਬੜੇ ਅੱਛੇ ਨੇ ਇੱਕ ਮੈਂ ਹੈਂਡ ਬਲੈਂਡਰ ਮੰਗਵਾਇਆ ਸੀ ਉਹ ਵੀ ਬਹੁਤ ਵਧੀਆ ਨਿਕਲਿਆ ਅੱਛਾ ਨਿਕਲਿਆ ਮਤਲਬ ਕਿ ਜਿਸ ਤਰ੍ਹਾਂ ਦੀ ਮੈਨੂੰ ਚਾਹੀਦਾ ਸੀਗਾ ਫਾਸਟ ਐ ਕੰਮ ਕੁਕਿੰਗ ਦੇ ਵਿੱਚ ਉਹ ਬੜਾ ਹੀ ਹੈਲਪ ਕਰਦਾ ਮੇਰਾ ਫਟਾਫਟ ਹੀ ਕੰਮ ਉਹਦੇ ਨਾਲ ਹ ਹੋ ਜਾਂਦਾ ਏ ਇਸ ਕਰਕੇ ਮੈਂ ਤੁਹਾਨੂੰ ਵੀ ਕਹਾਂਗੀ ਕਿ ਫੈਨ ਤਾਂ ਬਹੁਤ ਫੈਨ ਤਾਂ ਬਹੁਤ ਹੀ ਵਧੀਆ ਰਿਹਾ